ਹੈਲੋ ਹਾਂਜੀ ਅਸੀਂ ਫੋਰੈਸਟ ਡਿਪਾਰਟਮੈਂਟ ਤੋਂ ਹੀ ਗੱਲ ਕਰ ਰਹੇ ਹਾਂ ਤੁਹਾਡੀ ਕੀ ਮਦਦ ਕਰ ਸਕਦੇ ਹਾਂ ਅਸੀਂ ਹਾਂਜੀ ਉਹ ਡਿਫਰੈਂਟ ਸੀਜ਼ਨ ਦੇ ਅਕੋਰਡਿੰਗ ਨਾ ਆਪਾਂ ਅਲੱਗ ਅਲੱਗ ਤਰ੍ਹਾਂ ਦੇ ਫਲ ਸਬਜ਼ੀਆਂ ਉਗਾ ਸਕਦੇ ਹਾਂ ਜਿਵੇਂ ਆਪਾਂ ਘਰ 'ਚ ਉਗਾਉਂਦੇ ਹਾਂ ਤਾਂ ਆਪਾਂ ਜਿਵੇਂ ਸਰਦੀਆਂ ਵਿੱਚ ਪਾਲਕ ਹੋ ਗਈ ਸਾਗ ਹੋ ਗਿਆ ਇਹ ਜੇ ਆਪਾਂ ਘਰ ਬਹੁਤ ਈਜ਼ੀ ਤਰੀਕੇ ਨਾਲ ਪਕਾ ਸਕਦੇ ਹਾਂ ਉਗਾ ਸਕਦੇ ਹਾਂ ਇਹਨਾਂ ਨੂੰ ਵੀ ਜਿਵੇਂ ਕਿਉਂਕਿ ਇਸ ਮੌਸਮ ਵੀ ਹੁੰਦਾ ਮੌਸਮ ਦੇ ਹਿਸਾਬ ਨਾਲ ਸਬਜ਼ੀ ਉੱਗਦੀ ਹੈ ਜੇ ਤੁਹਾਨੂੰ ਪਤਾ ਹੀ ਜੇ ਆਪਾਂ ਪਾਲਕ ਸਾਗ ਨੂੰ ਗਰਮੀਆਂ 'ਚ ਲਾਵਾਂਗੇ ਤਾਂ ਉਹ ਕਦੇ ਨਹੀਂ ਉੱਗੇਗਾ ਇਸੇ ਤਰ੍ਹਾਂ ਜੇ ਤੁਸੀਂ ਕੋਈ ਫਰੂਟ ਉਗਾਉਣਾ ਚਾਹੁੰਦੇ ਹੋ ਜਿਵੇਂ ਸਰਦੀਆਂ ਵਿੱਚ ਅਨਾਰ ਹੋ ਗਿਆ ਨਾਖਾਂ ਹੋਗੀਆਂ ਅਮਰੂਦ ਇਹੋ ਜਿਹੀਆਂ ਚੀਜ਼ਾਂ ਬਹੁਤ ਛੇਤੀ ਉੱਗਦੀਆਂ ਅਤੇ ਹੋਰ ਇਸ ਤੋਂ ਇਲਾਵਾ ਹੁੰਦਾ ਵੀ ਗਰਮੀਆਂ ਦੇ ਮੌਸਮ ਦੇ ਵਿੱਚ ਤੁਸੀਂ ਜਿਵੇਂ ਕੱਦੂ ਤੋਰੀਆਂ ਕਰੇਲੇ ਇਹੋ ਜਿਹੇ ਸਬਜ਼ੀਆਂ ਨੂੰ ਤੁਸੀਂ ਘਰੇ ਉਗਾ ਸਕਦੇ ਹੋ ਪਰ ਸਾਰਾ ਗੱਲ ਮੇਨ ਇਹੀ ਹੈ ਇੱਕ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿਹੜੇ ਮੌਸਮ ਵਿੱਚ ਕਿਹੜਾ ਪਲਾਂਟ ਉਗਾਉਣਾ ਅਤੇ ਦੂਜੀ ਗੱਲ ਉਹਦੀ ਕੇਅਰ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਦੇ ਲਈ ਤੁਸੀਂ ਤੁਸੀਂ ਵੱਖ ਵੱਖ ਜਿਵੇਂ ਤੁਸੀਂ ਔਰਗੈਨਿਕ ਤਰੀਕੇ ਨਾਲ ਉਗਾਉਣਾ ਚਾਹੁੰਦੇ ਹੋ ਤਾਂ ਔਰਗੈਨਿਕ ਤਰੀਕੇ ਦੀਆਂ ਖਾਦਾਂ ਬਣਾ ਸਕਦੇ ਹੋ ਘਰੇ ਜਿਵੇਂ ਆਪਾਂ ਚਾਹ ਪੱਤੀ ਵਾਲੀ ਖਾਦ ਵੀ ਬਣਾ ਸਕਦੇ ਹਾਂ ਜਾਂ ਕੋਈ ਹੋਰ ਜਿਵੇਂ ਪੁਰਾਣੇ ਜ਼ਮਾਨੇ 'ਚ ਹੁੰਦਾ ਸੀ ਕੱਚੀ ਲੱਸੀ ਪਾਤੀ ਅਤੇ ਇੱਕ ਸਭ ਤੋਂ ਵਧੀਆ ਖਾਦ ਹੈਗੇ ਆ ਜਿਹੜੇ ਆਪਣੇ ਗਾਵਾਂ ਮੱਝਾਂ ਦਾ ਗੋਹਾ ਹੁੰਦਾ ਉਹ ਵੀ ਇੱਕ ਬਹੁਤ ਵਧੀਆ ਖਾਦ ਦਾ ਕੰਮ ਕਰਦਾ ਕਿਉਂਕਿ ਉਹ ਮਿੱਟੀ ਨੂੰ ਉਹਦੇ ਉਪਜਾਊ ਸ਼ਕਤੀ ਦਿੰਦਾ ਤਾਂ ਕਿ ਆਪਣੀ ਫਲ ਸਬਜ਼ੀ ਵਧੀਆ ਉੱਗੇ ਇਸ ਤੋਂ ਇਲਾਵਾ ਜੇ ਕੋਈ ਵੀ ਛਿੱਲੜ ਹੁੰਦੇ ਆ ਕਿਸੇ ਵੀ ਫਲ ਸਬਜ਼ੀ ਅਤੇ ਜਿਵੇਂ ਕੇਲੇ ਦੇ ਆਲੂ ਦੇ ਸੇਬ ਦੇ ਛਿਲਕੇ ਹੋ ਗਏ ਇਹਨਾਂ ਚੀਜ਼ਾਂ ਨੂੰ ਤੁਸੀਂ ਜਿਵੇਂ ਇੱਕ ਬਾਲਟੀ 'ਚ ਪਾ ਕੇ ਰੱਖ ਦੋ ਥੋੜ੍ਹੇ ਦਿਨਾਂ ਬਾਅਦ ਗੱਲਣੇ ਸ਼ੁਰੂ ਹੋ ਜਾਂਦੇ ਆ ਅਤੇ ਉਹ ਜਦੋਂ ਗਲ ਕੇ ਇੱਕ ਖਾਦ ਜੀ ਬਣ ਜੂਗੀ ਉਹ ਖਾਦ ਵੀ ਤੁਸੀਂ ਉਹਨਾਂ ਨੂੰ ਪਾ ਸਕਦੇ ਹੋ ਅਤੇ ਇਸ ਤੋਂ ਇਲਾਵਾ ਹੁੰਦਾ ਹੈ ਜਿਹੜੇ ਮਤਲਬ ਆਪਾਂ ਕੋਈ ਗੁਲਾਬ ਦੇ ਫੁੱਲ ਉਗਾ ਸਕਦੇ ਹਾਂ ਜਿਵੇਂ ਆਪਾਂ ਨੂੰ ਘਰੇ ਪਾਲਟੀ ਪਲਾਂਟਿੰਗ ਕਰਨ ਦਾ ਸ਼ੌਂਕ ਹੈ ਅਤੇ ਜਿਵੇਂ ਗਰਮੀਆਂ ਵਿੱਚ ਦੁਪਹਿਰ ਖਿੜੀ ਉਗਾ ਸਕਦੇ ਹਾਂ ਸਾਉਣ ਦੇ ਮਹੀਨੇ ਵਿੱਚ ਪੌਦੇ ਆ ਜਿਹੜੇ ਬਹੁਤ ਵਧੀਆ ਤਰ੍ਹਾਂ ਗਰੋਅ ਕਰਦੇ ਆ ਅਤੇ ਸਭ ਤੋਂ ਵੱਡੀ ਗੱਲ ਹੈ ਵੀ ਪੌਦੇ ਤੋਂ ਆਪਾਂ ਓਨੀ ਕੀ ਧੁੱਪ 'ਚ ਰੱਖਣਾ ਜਿੰਨੀ ਕੁ ਉਹਨੂੰ ਲੋੜ ਹੈ ਅਤੇ ਓਨੀ ਕ ਹੀ ਪਾਣੀ ਪਾਉਣਾ ਐਂ ਨਹੀਂ ਵੀ ਆਪਾਂ ਪਾਣੀ ਪਾਈ ਹੀ ਜਾਣਾ ਇਸ ਚੀਜ਼ ਦਾ ਵੀ ਸੜ ਜਾਂਦੇ ਆ ਪੌਦੇ ਹਾਂਜੀ ਤੋਂ ਇਲਾਵਾ ਜੇ ਤੁਹਾਨੂੰ ਕੋਈ ਮਦਦ ਦੀ ਲੋੜ ਹੋਈ ਤਾਂ ਅਸੀਂ ਬੈਠੇ ਹਾਂ ਤੁਸੀਂ ਸਾਨੂੰ ਜਦੋਂ ਮਰਜ਼ੀ ਕਾਲ ਕਰਕੇ ਕਿਸੇ ਮਰਜ਼ੀ ਚੀਜ਼ ਬਾਰੇ ਪੁੱਛ ਸਕਦੇ ਹੋ